ਹਾਂ ਮੇਰੇ ਕੋਲ ਮਨਪਸੰਦ ਸਾਹਿਤਕ ਪਾਤਰ ਹਨ ਬਲਵੰਤ ਗਾਰਗੀ ਜਿਨ੍ਹਾਂ ਨੂੰ ਮੈਂ ਬਹੁਤ ਪਸੰਦ ਕਰਦੀ ਹਾਂ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਜੋ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਹਾਲ ਹੀ ਦੇ ਵਿੱਚ ਮੈਂ ਉਹਨਾਂ ਦਾ ਇੱਕ ਇਕਾਂਗੀ ਪੜ੍ਹਿਆ ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ ਜੋ ਜਿਹਦੇ ਵਿੱਚ ਫੁੱਲਾਂ ਫੁੱਲ ਬੱਚਿਆਂ ਨੂੰ ਕਿਹਾ ਗਿਆ ਹੈ ਔਰ ਉਸ ਇਕਾਂਗੀ ਦੇ ਵਿੱਚ ਮਜ਼ੇਦਾਰ ਘਟਨਾ ਇਹ ਹੈ ਕਿ ਜਦੋਂ ਮਾਂ ਬਾਪ ਬੱਚਿਆਂ ਦਾ ਕਹਿਣਾ ਨਹੀਂ ਮੰਨਦੇ ਮਾਂ ਬਾਪ ਬੱਚਿਆਂ ਦੀ ਖੁਆਹਿਸ਼ਾਂ ਜਿਹੜੀਆਂ ਉਹ ਪੂਰੀਆਂ ਨਹੀਂ ਕਰਦੇ ਜਾਂ ਮਾਂ ਬਾਪ ਆਪਣੀਆਂ ਖੁਆਹਿਸ਼ਾਂ ਨੂੰ ਬੱਚਿਆਂ ਦੇ ਉੱਪਰ ਥੋਪਦੇ ਹਨ ਤਾਂ ਉਹਦੇ ਵਿੱਚ ਨੀਲ ਪਰੀ ਉਹਨਾਂ ਸਾਰਿਆਂ ਨੂੰ ਇੱਕ ਛੜੀ ਦੇ ਰਾਂ ਘੁੰਮਾ ਕੇ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਬਚਪਨ ਦੇ ਵਿੱਚ ਲੈ ਜਾਂਦੀ ਹੈ ਔਰ ਉਹ ਆਪਣੇ ਬਚਪਨ ਵਿੱਚ ਬੱਚਿਆਂ ਤੋਂ ਵੀ ਗਈਆਂ ਗੁਜਰੀਆਂ ਜਿਹੜੀਆਂ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ ਜੋ ਮੈਨੂੰ ਬਹੁਤ ਮਜ਼ੇਦਾਰ ਲੱਗਿਆ ਔਰ ਬਲਵੰਤ ਗਾਰਗੀ ਦੀਆਂ ਸਾਰੀਆਂ ਹੀ ਰਚਨਾਵਾਂ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹਨ